ਚਿੱਤਰਕਾਰੀ ਕਰਦੇ ਸਮੇਂ ਸਭ ਤੋਂ ਪਹਿਲਾਂ ਸਾਨੂੰ ਜਿਹੜਾ ਹੈਗਾ ਉਹਦਾ ਵਿੱਚ ਵਰਤੇ ਜਾਣ ਵਾਲੇ ਸ਼ੇਡ ਰੰਗ ਅਤੇ ਉਹਨਾਂ ਸਾਰੀਆਂ ਚੀਜ਼ਾਂ ਦਾ ਧਿਆਨ ਦੇਣਾ ਪੈਂਦਾ ਹੈ ਅਤੇ ਆਪਾਂ ਜਦੋਂ ਆਪਣਾ ਹਾਂ ਮਤਲਬ ਕਲਰ ਵਰਤਦੇ ਹੈ ਤਾਂ ਕਰੋਨ ਕਲਰ ਹੁੰਦੇ ਹਨ ਉਹਦੇ ਵਿੱਚ ਜਿਹੜਾ ਹੈਗਾ ਉਹਨੂੰ ਵਾ ਆਪਾਂ ਜਦੋਂ ਯੂਜ ਕਰਦੇ ਹੈ ਅਤੇ ਉਹਦੇ ਵਿੱਚ ਡਾਰਕ ਲਾਈਟ ਆਪਾਂ ਹਾਂ ਹਲਕਾ ਅਤੇ ਗੂੜ੍ਹਾ ਦੋਨਾਂ ਨੂੰ ਉਹ ਕਰ ਸਕਦੇ ਹੈਗੇ ਆਪਾਂ ਕਰ ਸਕਦੇ ਹਾਂ ਜਦੋਂ ਜਦੋਂ ਉਹ ਕਰੋਨ ਕਲਰ ਡਾਰਕ ਹੋ ਜਾਂਦੇ ਹਨ ਜਾਂ ਜ਼ਿਆਦਾ ਗੂੜ੍ਹੇ ਹੋ ਜਾਂਦੇ ਆਪਾਂ ਉਸ ਨੂੰ ਬਲੇਡ ਦੀ ਮਦਦ ਨਾਲ ਉਹਨੂੰ ਸਾਫ਼ ਕਰਕੇ ਥੋੜ੍ਹਾ ਜਿਹਾ ਹਲਕਾ ਵੀ ਕਰ ਸਕਦੇ ਹਾਂ ਰੰਗ ਅਤੇ ਉਹਦੇ ਨਾਲ ਜਿਹੜਾ ਹੈਗਾ ਇਹ ਰੰਗ ਸਾਫ਼ ਵੀ ਹੁੰਦਾ ਹੈ ਅਤੇ ਉਹਦੇ ਵਿੱਚ ਜਿਹੜੀ ਸਫ਼ਾਈ ਵੀ ਆਉਂਦੀ ਹੈ ਅਤੇ ਉਹਦੇ ਨਾਲ ਜਿਹੜਾ ਉਹਦਾ ਮਤਲਬ ਹਲਕਾ ਜਾਂ ਕਿਤੋਂ ਆਪਾਂ ਗੂੜ੍ਹਾ ਦੇਣਾ ਅਤੇ ਕਿਤੋਂ ਆਪਾਂ ਹਲਕਾ ਦੇਣਾ ਉਸ ਰੰਗ ਨੂੰ ਅਤੇ ਉਹਨਾਂ ਦੋਨੋਂ ਦੀ ਆਪਾਂ ਜਿਹੜੀ ਸ਼ੇਡ ਹੈਗੀ ਹੈਗੀ ਉਨ੍ਹਾਂ ਦੋਨਾਂ ਨੂੰ ਮਿਕਸ ਕਰਕੇ ਆਪਾਂ ਸਹੀ ਤਰੀਕੇ ਨਾਲ ਉਹਦੀ ਵਰਤੋਂ ਕਰ ਸਕਦੇ ਹਾਂ ਜਿਵੇਂ ਕਿ ਆਪਾਂ ਹਾਂ ਦਰਖਤ ਦਾ ਪਰਛਾਵਾ ਬਣਾਉਣਾ ਹੁੰਦਾ ਹੈ ਜਦੋਂ ਆਪਾਂ ਦਰਖਤ ਬਣਾਉਂਦੇ ਹਾਂ ਅਤੇ ਜਿਹੜੀ ਉਹਦਾ ਛਾਂ ਹੁੰਦੀ ਆ ਉਹ ਸਾਈਡ ਤੋਂ ਆਪਾਂ ਬਿਲਕੁਲ ਹਲਕੀ ਹਲਕੀ ਪੈਨਸਲ ਨਾਲ ਉਹਦੇ ਜਿਹੜੇ ਹੈਗੀ ਹੈ ਛਾਂ ਉਹਦਾ ਦ੍ਰਿਸ਼ ਬਣਾ ਸਕਦੇ ਹੈਗੇ ਹਾਂ ਉਹ ਜਿਹੜਾ ਪੇੜ ਬਣਾਇਆ ਹੋਇਆ ਉਹਦਾ ਤਾਂ ਆਪਾਂ ਉਹਦੇ 'ਚ ਤਾਂ ਹਰਾ ਰੰਗ ਯੂਜ ਕਰਦੇ ਹਾਂ ਪਰ ਜਿਹੜੀ ਪਰਛਾਈ ਹੁੰਦੀ ਹੈ ਉਹ ਹਮੇਸ਼ਾ ਲਾਈਟ ਕਲਰ ਦੀ ਹੁੰਦੀ ਹੈ ਅਤੇ ਆਪਾਂ ਉਸ ਨੂੰ ਹਲਕੇ ਕਲਰ ਨੂੰ ਪੈਨਸਲ ਜਾਂ ਹਲਕੇ ਬਿਲਕੁਲ ਕਰੋਨ ਕਲਰ ਯੂਜ ਕਰਕੇ ਉਹਦੀ ਪਰਛਾਈ ਬਹੁਤ ਵਧੀਆ ਤਰੀਕੇ ਦੇ ਨਾਲ ਬਣਾ ਸਕਦੇ ਹਾਂ ਇਹਦੇ ਨਾਲ ਜਿਹੜਾ ਸਟੇਸ਼ਨਰੀ ਦਾ ਸਮਾਨ ਹੁੰਦਾ ਹੈ ਉਹਦੇ ਵੀ ਜ਼ਿਆਦਾ ਮਹਿੰਗਾ ਨਹੀਂ ਹੁੰਦਾ ਅਤੇ ਉਹਨੂੰ ਮਤਲਬ ਥੋੜ੍ਹੇ ਆਪਾਂ ਪੈਸਿਆਂ ਦੇ ਵਿੱਚ ਆਪਾਂ ਵਧੀਆ ਚਿੱਤਰਕਾਰੀ ਆਪਾਂ ਕਰ ਸਕਦੇ ਹਾਂ ਇਹਦੇ ਨਾਲ